ਸਾਡੇ ਵੇਲੇ ਦੀ ਪੰਜਾਬੀ ਭਾਸ਼ਾ ਦਾ ਅਤੇ ਹੁਣ ਵਾਲੀ ਭਾਸ਼ਾ ਦਾ ਬਹੁਤ ਜ਼ਿਆਦਾ ਫਰਕ ਆ ਮੈਂ ਫੌਜ ਦੇ ਵਿੱਚ ਨੌਕਰੀ ਕਰਦਾ ਹੁੰਦਾ ਸੀ ਉਸ ਵੇਲੇ ਮੈਂ ਪੰਜਾਬੀ ਵਿੱਚ ਹੀ ਚਿੱਠੀ ਲਿਖਦਾ ਪੰਜਾਬੀ ਵਿੱਚ ਹੀ ਮੈਂ ਸ ਸਾਰਾ ਕੰਮ ਕਰਦਾ ਸੀ ਮੈਂ ਫੌਜ ਦੇ ਵਿੱਚ ਹੁੰਦਿਆਂ ਪੰਜਾਬੀ ਭਾਸ਼ਾ ਦੇ ਨਾਲ ਅਰੁਣਾਚਲ ਪ੍ਰਦੇਸ਼ ਗਿਆ ਹਿਮਾਚਲ 'ਚ ਗਿਆ ਔਰ ਲੇਹ ਲਦਾਖ ਗਿਆ ਸਭ ਤੋਂ ਜ਼ਿਆਦਾ ਮੈਂ ਰਾਜਸਥਾਨ ਦੇ ਵਿੱਚ ਰਿਹਾ ਅਤੇ ਪੰਜਾਬੀ ਭਾਸ਼ਾ ਉਦੋਂ ਅਤੇ ਹੁਣ ਦੇ ਵਿੱਚ ਬਹੁਤ ਤਬਦੀਲ ਹੋ ਗਈ ਹੈ ਦੇਖਿਆ ਜਾਂਦਾ ਕਿ ਪੰਜਾਬੀ ਨਾਲੋਂ ਹਿੰਦੀ ਵੀ ਵੱਧ ਗਈ ਹੈ ਅਤੇ ਹਿੰਦੀ ਨਾਲੋਂ ਅੰਗਰੇਜ਼ੀ ਵੱਧ ਗਈ ਹੈ ਹੁਣ ਸਾਡੇ ਬੱਚਿਆਂ ਦਾ ਅਤੇ ਸਾਡਾ ਪੰਜਾਹ ਪਰਸੈਂਟ ਤੋਂ ਵੀ ਜ਼ਿਆਦਾ ਫਰਕ ਪੈ ਗਿਆ ਜੋ ਅਸੀਂ ਨੱਬੇ ਪਚਾਨਵੇਂ ਜਾਂ ਸੱਤਰ ਅੱਸੀ ਬੋਲਦੇ ਸੀ ਹੁਣ ਉਹ ਸਾਨੂੰ ਹੰਡਰਡ ਨਾਈਨਟੀ ਅਤੇ ਜਾਂ ਥਰਟੀ ਨਾਈਨ ਬੋਲੀਏ ਉਣਤਾਲੀ ਨੂੰ ਉਹ ਨਹੀਂ ਸਮਝਦੇ ਜੇ ਅਸੀਂ ਬੋਲਦੇ ਹਾਂ ਉਣਤਾਲੀ ਤਾਂ ਉਹ ਨਹੀਂ ਸਮਝੇ ਬਹੁਤ ਵੱਡੀ ਇਹ ਤਬਦੀਲੀ ਆ ਗਈ ਪੰਜਾਬੀ ਬੋਲੀ ਦੇ ਵਿੱਚ ਸਭ ਪੰਜਾਬੀ ਬੋਲੀ ਤੋਂ ਅੱਗੇ ਅੰਗਰੇਜ਼ੀ ਵੱਧ ਗਈ ਅੰਗਰੇਜ਼ੀ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਪੋਤੇ ਪੋਤੀਆਂ ਸਾਨੂੰ ਆਖਣਗੇ ਦਾਦਾ ਜੀ ਸਿਕਸਟੀ ਨਾਈਨ ਬੋਲੋ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਿਕਸਟੀ ਨਾਈਨ ਕੀ ਹੈ ਫਿਰ ਉਹ ਸਾਨੂੰ ਦੱਸਦੇ ਹੈ ਸਿਕਸ ਨਾਈਨ ਬੋਲੋ ਫਿਰ ਅਸੀਂ ਆਖਦੇ ਹਾਂ ਇਹ ਤਾਂ ਉਣਹੱਤਰ ਹੈ ਫਿਰ ਉਹ ਬਹੁਤ ਹੱਸਦੇ ਨੇ ਇੰਨਾ ਪੰਜਾਬੀ ਦਾ ਅਤੇ ਅੰਗਰੇਜ਼ੀ ਦਾ ਫਰਕ ਪੈ ਗਿਆ ਜੀ ਆਉਣ ਵਾਲੀਆਂ ਪੀੜ੍ਹੀਆਂ ਦੇ ਵੇਖੋ ਹੁਣ ਕੀ ਬਣਦਾ ਅਤੇ ਕੀ ਹੋਊਗਾ ਅਸੀਂ ਤਾਂ ਇਹੀ ਆਖਦੇ ਹਾਂ ਕਿ ਪੰਜਾਬੀ ਨੂੰ ਹਰ ਸੂਬੇ ਦੇ ਵਿੱਚ ਹਰ ਭਾਸ਼ਾ ਦੇ ਬਰਾਬਰ ਚਾਲੂ ਕੀਤਾ ਜਾਵੇ ਯੂਨੀਵਰਸਿਟੀਆਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਭ ਇਹ ਲਾਗੂ ਹੋਣੀ ਚਾਹੀਦੀ ਹੈ ਜੀ